ਹਾਂਜੀ ਇੱਕ ਵਾਰੀ ਦੀ ਗੱਲ ਹੈ ਜੋ ਕਿ ਮੈਂ ਆਪਣੀ ਬੀਤੀ ਦੱਸਦਾ ਹਾਂ ਪਿਛਲੇ ਦਿਨ ਮੇਰੇ ਦੋਸਤ ਘਰ ਆਏ ਹੋਏ ਸੀ ਅਤੇ ਮੇਰਾ ਜਨਮਦਿਨ ਸੀ ਆਪਣੇ ਜਨਮਦਿਨ 'ਤੇ ਮੈਂ ਔਨਲਾਈਨ ਖਾਣਾ ਔਡਰ ਕਰ ਦਿੱਤਾ ਸੀ ਅਤੇ ਪੇਮੈਂਟ ਵੀ ਔਟੋਪੇਅ ਹੋ ਗਈ ਸੀ ਅਤੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਅਤੇ ਔਡਰ ਕੈਂਸਲ ਕਰਨਾ ਚਾਹੁੰਦਾ ਸੀ ਮੈਂ ਆਪਣੀ ਵੈੱਬਸਾਈਡ ਦੀ ਸੈਟਿੰਗ ਵਿੱਚ ਜਾ ਕੇ ਔਟੋਪੇਅ ਬੰਦ ਕੀਤਾ ਅਤੇ ਔਡਰ ਕੈਂਸਲ ਕੀਤਾ ਅਤੇ ਹੋਰ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ